ਖੇਤੀਬਾੜੀ ਵਿੱਚ ਆਉਣ ਵਾਲੀ ਪੀੜ੍ਹੀ ਲਈ ਸੁਝਾਅ ਮੈਨੂੰ ਇੰਝ ਲੱਗਦਾ ਹੈ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਉਸ ਵਿੱਚ ਨੌਜਵਾਨ ਜ਼ਿਆਦਾਤਰ ਤਾਂ ਮਸ਼ੀਨੀ ਯੁੱਗ ਕਰਕੇ ਹੱਥੀਂ ਕੰਮ ਕਰਕੇ ਤਾਂ ਰਾਜ਼ੀ ਹੀ ਨਹੀਂ ਹਨ ਕਿਉਂਕਿ ਪੁਰਾਣੇ ਸਮੇਂ ਵਿੱਚ ਤਾਂ ਬਲਦਾਂ ਰਾਹੀਂ ਅਤੇ ਹ ਆਪ ਹੱਥੀਂ ਕਰਕੇ ਫਸਲਾਂ ਆਦਿ ਬੀਜੀਆਂ ਜਾਂਦੀਆਂ ਸਨ ਅਤੇ ਹੁਣ ਮਸ਼ੀਨਰੀ ਦੇ ਯੁੱਗ ਵਿੱਚ ਤਾਂ ਦਸ ਮਿੰਟ ਵਿੱਚ ਹੀ ਖੇਤ ਵਾਹ ਕੇ ਬੀਜ ਦਿੱਤੇ ਜਾਂਦੇ ਹਨ ਅਤੇ ਉੱਪਰ ਫਸਲਾਂ ਨੂੰ ਉਪਜਾਊ ਕਰਨ ਲਈ ਸਫਲਤਾਪੂਰਵਕ ਬਣਾਉਣ ਲਈ ਉੱਪਰ ਸਪਰੇਹਾਂ ਸਪਰੇਹਾਂ ਵਗੈਰਾ ਕੈਮੀਕਲ ਕੀਤੇ ਜਾਂ ਕੈਮੀਕਲ ਦ ਆਦਿ ਪਾਏ ਜਾਂਦੇ ਹਨ ਤਾਂ ਜੋ ਫ਼ਸਲ ਭਰਪੂਰ ਹੋ ਜੂਗੀ ਅਤੇ ਮੁਨਾਫ਼ਾ ਕਮਾਇਆ ਜਾ ਸਕੇ ਅਤੇ ਅਸੀਂ ਆਪਣੀ ਮਿੱਟੀ ਨੂੰ ਸਪਰੇਹਾਂ ਪਾ ਪਾ ਕੇ ਜ਼ਹਿਰੀਲੇ ਪਦਾਰਥ ਪਾ ਪਾ ਕੇ ਮਿੱਟੀ ਉਪਜਾਊ ਤੋਂ ਬੰਜਰ ਕਰ ਰਹੇ ਹਾਂ ਅਤੇ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਘੱਟਦੀ ਜਾ ਰਹੀ ਹੈ ਜਿਸ ਕਰਕੇ ਫਸਲਾਂ ਜੋ ਹੋ ਰਹੀਆਂ ਹਨ ਉਹ ਨੁਕਸਾਨਦਾਇਕ ਹੀ ਕਹਿਲਾ ਰਹੀਆਂ ਹਨ ਅਤੇ ਖੇਤੀਬਾੜੀ ਵਿੱਚ ਆਉਣ ਵਾਲੀ ਪੀੜ੍ਹੀ ਲਈ ਇਹ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ ਕਿ ਜੋ ਅਸੀਂ ਆਪਣੇ ਖੇਤਾਂ ਵਿੱਚ ਸਪਰੇਹਾਂ ਆਦਿ ਜ਼ਹਿਰੀਲੇ ਕੈਮੀਕਲ ਪਾ ਕੇ ਆਪਣੀ ਫਸਲ ਨੂੰ ਉਪਜਾ ਉਪਜਾਊ ਕਰ ਰਹੇ ਹਾਂ ਉਹ ਸਾਡੇ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ ਇਸ ਲਈ ਸਾਨੂੰ ਸਪਰੇਹਾਂ ਆਦਿ ਦਾ ਘੱਟ ਉਪਯੋਗ ਕਰਨਾ ਚਾਹੀਦਾ ਹੈ ਫ਼ਸਲਾਂ ਬੀਜਣ ਵੇ ਵੇਲੇ ਅਤੇ ਜ਼ਿਆਦਾਤਰ ਦੇਸੀ ਖਾਦ ਰੂੜੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਾਂ ਖੇਤੀਬਾੜੀ ਵਿੱਚ ਆਉਣ ਵਾਲੀ ਪੀੜ੍ਹੀ ਦਾ ਮੁਸ਼ਕਲ ਲੱਗ ਰਿਹਾ ਹੈ ਕਿ ਇਹ ਜ਼ਿਆਦਾਤਰ ਖੇਤੀਬਾੜੀ ਤੋਂ ਅੱਕ ਰਹੇ ਹਨ ਅਤੇ ਮਸ਼ੀਨਰੀ ਯੁੱਗ ਮਸ਼ੀਨੀ ਯੁੱਗ ਦੀ ਮ ਕਾਰਨ ਖੇਤੀਬਾੜੀ ਤਾਂ ਖੁੰਝਦੀ ਜਾ ਰਹੀ ਹੈ ਅਤੇ ਬਹੁਤ ਵੱਡਾ ਇੱਕ ਮਸਲਾ ਬਣ ਚੁੱਕਿਆ ਹੈ ਕਿ ਜੋ ਖੇਤੀਬਾੜੀ ਹੈ ਉਹ ਝੋਨੇ ਜੋ ਪਾਣੀ ਧਰਤੀ ਦਾ ਮੁੱਕਦਾ ਜਾ ਰਿਹਾ ਹੈ ਝੋਨੇ ਲਗਾ ਲਗਾ ਕੇ ਅਤੇ ਅਸੀਂ ਆਪਣੀ ਵਾ ਜਿਹੜਾ ਵਾਯੂ ਹੈ ਉਸ ਨੂੰ ਵੀ ਸਪਰੇਹਾਂ ਲਗਾ ਲ ਸਪਰੇਹਾਂ ਲਗਾ ਕੇ ਜ਼ਹਿਰੀਲਾ ਬਣਾ ਰਹੇ ਹਾਂ ਅਤੇ ਆਉਣ ਵਾਲੀ ਪੀੜ੍ਹੀ ਲਈ ਇਹ ਖ਼ਤਰਨਾਕ ਸਾਬਤ ਹੋ ਸਕਦਾ ਹੈ